ਹੈਲੋ ਮੇਰੀ ਗੱਲ ਅਸ਼ਨੀਤ ਜੀ ਨਾਲ ਹੋ ਰਹੀ ਹੈ ਮੈਨੂੰ ਤੁਹਾਡਾ ਨੰਬਰ ਨਾ ਕਿਸੇ ਰਿਲੇਟਿਵ ਨੇ ਦਿੱਤਾ ਆ ਅਤੇ ਮੈਂ ਡੈਲੀ ਤੋਂ ਅੰਮ੍ਰਿਤਸਰ ਆਈ ਹਾਂ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਟੂਰਿਸਟ ਗਾਈਡਰ ਹੋ ਅਤੇ ਬੜਾ ਵਧੀਆ ਗਾਈਡ ਕਰਦੇ ਹੋ ਅਤੇ ਮੈਂਨੂੰ ਤੁਸੀਂ ਫੇਮਸ ਪਾਰਕ ਬਾਰੇ ਦੱਸ ਸਕਦੇ ਓਂ ਅੰਮ੍ਰਿਤਸਰ 'ਚ ਹਾਂਜੀ ਦੱਸੋਗੇ

ਹਾਂਜੀ ਹਾਂਜੀ ਅੱਛਾ ਅਤੇ ਹੋਰ ਕੋਈ ਪਾਰਕਸ ਵਗੈਰਾ ਅੱਛਾ ਅੱਛਾ ਅਤੇ ਜੇ ਮੈਮ ਮੈਂ ਉਹਨਾਂ ਨੂੰ ਐਡਰੈਸ ਦੱਸਣਾ ਹੋਏਗਾ ਜਿੱਦਾਂ ਮੈਂ ਕੈਬ ਬੁੱਕ ਕਰੀ ਆ ਉਹਨਾਂ ਨੂੰ ਰੇਲਵੇ ਸਟੇਸ਼ਨ ਤੋਂ ਮੈਂ ਕੀ ਕਵਾਂ ਕੀ ਕਿੱਥੇ ਜਾਣਾ ਏ ਆ ਚਲੋ ਠੀਕ ਹੈ ਮੈਮ ਮੇਰੀ ਕੈਬ ਆ ਗਈ ਹੈ ਥੈਂਕ ਯੂ